ਗਾਉਣ ਤੋਂ ਪਹਿਲਾਂ ਮੈਂ ਆਪਣੇ ਬੈਂਡ ਵਾਲਿਆਂ ਨਾਲ ਪਹਿਲਾਂ ਪ੍ਰੈਕਟਿਸ ਕਰਦੀ ਹਾਂ ਅਤੇ ਜਦੋਂ ਸਟੇਜ ਉੱਪਰ ਗਾਉਂਦੀ ਹਾਂ ਜਾਂ ਕਿਤੇ ਵੀ ਗਾਣਾ ਰਿਕਾਰਡ ਕਰਦੀ ਹਾਂ ਤਾਂ ਮੈਂ ਉਹਨਾਂ ਨਾਲ ਪੂਰਾ ਸਹਿਯੋਗ ਕਰਦੀ ਹਾਂ ਜਿੱਥੋਂ ਕਿਤੇ ਵੀ ਸੁਰ ਉੱਪਰ ਜਾਂ ਹੇਠਾਂ ਕਰਨਾ ਹੁੰਦਾ ਤਾਂ ਇਸ਼ਾਰੇ ਦੇ ਨਾਲ ਉਹਨਾਂ ਨਾਲ ਗੱਲ ਕਰਦੀ ਹਾਂ ਇਸ ਤਰ੍ਹਾਂ ਮੈਂ ਉਹਨਾਂ ਨਾਲ ਪੂਰਾ ਸਹਿਯੋਗ ਕਰਦੀ ਹਾਂ